ਮੇਰੇ ਦੋਸਤ ਨੇ ਇੱਕ ਮੈਨੂੰ ਕਿਤਾਬ ਦਿੱਤੀ ਅਤੇ ਮੈਂ ਉਹਦਾ ਜਿਹੜਾ ਉੱਪਰਲਾ ਦਿਤ ਦਿੱਤਾ ਹੋਇਆ ਪੰਨਾ ਸੀਗਾ ਉਹਨੂੰ ਮੈਂ ਦੇਖਿਆ ਬੜੇ ਧਿਆਨ ਨਾਲ਼ ਉਹਦੇ 'ਤੇ ਅਜੀਬ ਜਿਹੀ ਫੋਟੋ ਲੱਗੀ ਹੋਈ ਪਰ ਮਨ ਨੂੰ ਥੋੜ੍ਹੀ ਜਿਹੀ ਉਹ ਜਚੀ ਨਹੀਂ ਗੱਲ ਪਰ ਉਹਦੇ ਵਿੱਚ ਜਦੋਂ ਥੋੜ੍ਹਾ ਜਿਹਾ ਮੈਂ ਪੜ੍ਹ ਕੇ ਦੇਖਿਆ ਅਤੇ ਉਹਦੇ ਵਿੱਚ ਅਜੀਬ ਜਿਹੀਆਂ ਗੱਲਾਂ ਅਜੀਬ ਜਿਹੇ ਚੁਟਕਲੇ ਅਜੀਬ ਜਿਹੇ ਬੋਲਬਾਣੀ ਦੇ ਸ਼ਬਦ ਲਿਖੇ ਹੋਏ ਸੀਗੇ ਅਤੇ ਮੈਨੂੰ ਉਹ ਬਿਲਕੁਲ ਹੀ ਪਸੰਦ ਨਹੀਂ ਆਈ ਪਰ ਉਸ ਨੇ ਮੈਨੂੰ ਬੜੀ ਸਿਫਾਰਿਸ਼ ਕਰੀ ਜ਼ੋਰ ਕੀਤਾ ਸਿਫਾਰਿਸ਼ ਕੀਤੀ ਜਾਂ ਜ਼ੋਰ ਦਿੱਤਾ ਇਸ ਗੱਲ ਉਸ ਗੱਲ ਦੇ ਉੱਤੇ ਵੀ ਤੂੰ ਪੜ੍ਹਦਾ ਕਿਉਂ ਨਹੀਂ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਮੈਂ ਕਿਹਾ ਵੀ ਮੈਨੂੰ ਸਮਝ ਤਾਂ ਆਉਂਦੀ ਆ ਪਰ ਗੱਲ ਇਹ ਆ ਵੀ ਇਹ ਮੈਨੂੰ ਗੱਲਾਂ ਪਸੰਦ ਨਹੀਂ ਹੈਗੀਆਂ ਕਿਉਂਕਿ ਇਹ ਨਾ ਤਾਂ ਪਰਿਵਾਰਕ ਨਾਤੇ ਵਿੱਚ ਪੜ੍ਹੀ ਜਾ ਸਕਦੀ ਹੈ ਨਾ ਹੀ ਇਹ ਆਪਣੇ ਲਹਿਜ਼ੇ ਤੋਂ ਬਾਹਰ ਮੇਰੀ ਸੋਚ ਕੁਛ ਹੋਰ ਢੰਗ ਦੀ ਆ ਕਿਤਾਬ ਦੀ ਲਿਖਣੀ ਦੀ ਜਿਹੜੀ ਸੋਚ ਸੀਗੀ ਉਹ ਹੋਰ ਢੰਗ ਦੀ ਹੈ ਚਾਹੇ ਸਾ ਕਈ ਲੋਕਾਂ ਨੂੰ ਹਾਂ ਕਈ ਲੋਕਾਂ ਨੂੰ ਪਸੰਦ ਵੀ ਆਉਂਦੀ ਆ ਵੀ ਇਹ ਚੀਜ਼ ਵਧੀਆ ਉਹਨਾਂ ਲਈ ਵਧੀਆ ਹੋਵੇਗੀ ਪਰ ਮੇਰੇ ਲਈ ਇਸ ਕਰਕੇ ਵਧੀਆ ਨਹੀਂ ਕਿਉਂ ਉਹ ਉਹਦੀ ਜਿਹੜੀ ਜਾਨੀ ਕਿ ਲੈਂਗੁ ਭਾਸ਼ਾ ਸੀਗੀ ਉਹ ਮੈਨੂੰ ਜਚੀ ਨਹੀਂ